ਸਿਹਤਮੰਦ ਪਕਵਾਨ ਹੁੰਦੇ ਆ ਇਹ ਵੀ ਜਿਵੇਂ ਕੁਝ ਹਰੀਆਂ ਸਬਜ਼ੀਆਂ ਅਤੇ ਗੋਭੀ ਭਿੰਡੀਆਂ ਕੋਈ ਸਾਰੀਆਂ ਸਬਜ਼ੀਆਂ ਜਿੱਦਾਂ ਆਪਾਂ ਜਿਨ੍ਹਾਂ ਨੂੰ ਗਿਣ ਸਕਦੇ ਹਾਂ ਜਿਵੇਂ ਫਰੂਟ ਸਿਹਤਮੰਦ ਹੁੰਦੇ ਆ ਆਪਾਂ ਉਹ ਖਾ ਸਕਦੇ ਹਾਂ ਫਰੂਟ ਆਪਾਂ ਉੱਦਾਂ ਹੀ ਖਾ ਸਕਦੇ ਹਾਂ ਉਹਨੂੰ ਸਿਰਫ ਧੋਵੋ ਅਤੇ ਖਾ ਲਓ ਅਤੇ ਜਿਹੜੀਆਂ ਸਬਜ਼ੀਆਂ ਹੁੰਦੀਆਂ ਸਿਹਤਮੰਦ ਪਕਵਾਨ ਜਿਹੜਾ ਆਪਾਂ ਘਰ 'ਚ ਤਿਆਰ ਕਰਦੇ ਹਾਂ ਉਹ ਇਹ ਹੁੰਦੇ ਆਪਣੇ ਪਰਿਵਾਰ ਨੂੰ ਖਵਾਉਣ ਵਾਸਤੇ ਹਰੀਆਂ ਸਬਜ਼ੀਆਂ ਜਿਵੇਂ ਗੋਭੀ ਹੋ ਗਈ ਪਾਲਕ ਹੋ ਗਈ ਸਾਗ ਹੋ ਗਿਆ ਅਤੇ ਭਿੰਡੀਆਂ ਹੋ ਗਈਆਂ ਤੋਰੀਆਂ ਹੋ ਗਈਆਂ ਹਰ ਇੱਕ ਚੀਜ਼ ਜਿਹੜੀ ਆਪਾਂ ਘਰ 'ਚ ਤਿਆਰ ਕਰ ਸਕਦੇ ਹਾਂ ਅਤੇ ਜਿਹੜੇ ਜਿਵੇਂ ਆਪਾਂ ਜੂਸ ਫਰੂਟ ਤੋਂ ਆਪਾਂ ਜੂਸ ਬਣਾ ਸਕਦੇ ਹਾਂ ਆਪਣੇ ਬੱਚਿਆਂ ਨੂੰ ਪਿਆਉਣ ਵਾਸਤੇ ਹਰ ਇੱਕ ਚੀਜ਼ ਜਿੱਦਾਂ ਆਪਾਂ ਕਿਤੇ ਵਿਆਹ ਸ਼ਾਦੀ 'ਚ ਚਲੇ ਜਾਂਦੇ ਹਾਂ ਪਰ ਉੱਥੇ ਆਪਾਂ ਨੂੰ ਹਰ ਇੱਕ ਚੀਜ਼ ਮਿਲ ਜਾਂਦੀ ਆ ਖਾਣ ਨੂੰ ਵਿਆਹਵਾਂ ਵਿੱਚ ਪਰ ਸਾਨੂੰ ਉਹ ਸਿਹਤਮੰਦ ਖਾਣਾ ਨਹੀਂ ਹੁੰਦਾ ਵੀ ਅਸੀਂ ਆਪਣੇ ਪਰਿਵਾਰ ਲਈ ਖੁਦ ਆਪਣੇ ਹੱਥਾਂ ਨਾਲ ਤਿਆਰ ਖਾਣਾ ਕਰਕੇ ਬਣਾ ਸਕਦੇ ਹਾਂ ਹਰੀਆਂ ਸਬਜ਼ੀਆਂ ਕੱਚੀਆਂ ਸਬਜ਼ੀਆਂ ਆਪਣੇ ਪਰਿਵਾਰ ਨੂੰ ਦੇਈਏ ਜਿਹਦੇ ਨਾਲ ਆਪਣੇ ਪਰਿਵਾਰ ਦੀ ਸਿਹਤ ਚੰਗੀ ਰਹੇ ਆਪਣੇ ਬੱਚਿਆਂ ਦੀ ਸਿਹਤ ਚੰਗੀ ਰਹੇ ਜਿਹਦੇ ਨਾਲ ਅਸੀਂ ਸਾਰੇ ਖੁਸ਼ ਰਹਿ ਸਕੀਏ